ਭਾਰਤੀ ਮੀਡੀਆ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਜ਼ਿੰਮੇਵਾਰ ਰੋਲ ਅਦਾ ਕਰਦਾ ਹੈ ਅਲੱਗ ਅਲੱਗ ਖੇਤਰਾਂ ਦੇ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਹਰ ਤਰ੍ਹਾਂ ਦੇ ਨਿਊਜ਼ ਚੈਨਲ ਅਤੇ ਅਖਬਾਰਾਂ ਆਦਿ ਮੌਜੂਦ ਹਨ ਸਵੇਰੇ ਉੱਠਦਿਆਂ ਸਾਰ ਹੀ ਸਾਨੂੰ ਆਪਣੇ ਦੇਸ਼ ਦੇ ਹਾਲਾਤ ਬਾਰੇ ਪਤਾ ਲੱਗ ਜਾਂਦਾ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਸ ਦੀ ਹਰ ਇੱਕ ਨੋਲੇਜ ਅਖਬਾਰਾਂ ਅਤੇ ਟੀ ਵੀ ਰਾਹੀਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਇੰਟਰਨੈਸ਼ਨਲ ਸਰਗਰਮੀਆਂ ਲੋਕਲ ਨਿਊਜ਼ ਸਾਡੇ ਸ਼ਹਿਰ ਵਿੱਚ ਅੱਜ ਕੀ ਹੋ ਰਿਹਾ ਹੈ ਸਾਰਾ ਕੁਛ ਨਿਊਜ਼ ਚੈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਅੱਜ ਦੇ ਰੇਟ ਕੀ ਨੇ ਸਬਜ਼ੀਆਂ ਦੇ ਰੇਟ ਕੀ ਨੇ ਗਰੋਸਰੀ ਦੇ ਰੇਟ ਕੀ ਨੇ ਕਿਸੇ ਵੀ ਸ਼ਾਦੀ ਵਿਆਹ ਦਾ ਕਿਸੇ ਦੇ ਮਕਾਨ ਵੇਚਣ ਦਾ ਹਰ ਤਰੀਕੇ ਦਾ ਐਡਵਰਟਾਈਜਮੈਂਟ ਸਾਨੂੰ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਵਿੱਚ ਵੀ ਮਿਲ ਜਾਂਦਾ ਹੈ ਵਧੀਆ ਵਧੀਆ ਕੰਪਨੀਆਂ ਦੇ ਪ੍ਰੋਡਕਟਾਂ ਬਾਰੇ ਐਡਵਰਟਾਈਜਮੈਂਟ ਦੇ ਰੂਪ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ ਨਿਊਜ਼ ਚੈਨਲ ਦੇ ਵਿੱਚ ਮੌਸਮ ਦਾ ਹਾਲ ਵੀ ਦੱਸਿਆ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਨਿਊਜ਼ ਚੈਨਲਸ ਸਾਨੂੰ ਨੌਲੇਜ ਦੇਣ ਦੀ ਜ਼ਿੰਮੇਵਾਰੀ ਪੂਰੀ ਕਰਦੇ ਹਨ